ਸਾਡੇ ਪਿੰਡ ਦੇ ਨੌਜਵਾਨ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਦੇ ਹਨ ਜਿਵੇਂ ਕਿ ਇੱਕ ਮਸ਼ਹੂਰ ਸਕੀਮ ਚੱਲੀ ਹੋਈ ਹੈ ਜਿਸ ਨੂੰ ਕਿ ਨਰੇਗਾ ਸਕੀਮ ਕਹਿੰਦੇ ਹਨ ਜੋ ਕਿ ਸਰਕਾਰ ਵੱਲੋਂ ਚਲਾਈ ਗਈ ਹੈ ਉਸ ਵਿੱਚ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਸੌ ਦਿਨਾਂ ਦਾ ਕੰਮ ਦਿੱਤਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਹੀ ਪੈਸੇ ਦਿੱਤੇ ਜਾਂਦੇ ਹਨ ਉਸ ਤੋਂ ਇਲਾਵਾ ਡੇਅਰੀ ਫਾਰਮ ਖੋਲ੍ਹੇ ਹੋਏ ਹਨ ਚਾਰ ਪੰਜ ਡੇਅਰੀ ਫਾਰਮ ਹਨ ਅਤੇ ਉਹਨਾਂ ਨੇ ਮੱਝਾਂ ਰੱਖੀਆ ਹੋਈਆਂ ਹਨ ਦੁੱਧ ਦਾ ਕੰਮ ਕਰਦੇ ਹਨ ਅਤੇ ਮੱਝਾਂ ਦੀ ਦੇਖ ਰੇਖ ਲਈ ਵੀ ਪਿੰਡ ਦੇ ਹੀ ਨੌਜਵਾਨ ਰੱਖੇ ਹੋਏ ਹਨ ਅਤੇ ਬਾਕੀ ਜਿਹੜੇ ਕਿਸਾਨੀ ਦਾ ਕੰਮ ਕਰਦੇ ਹਨ ਜਿਨਾਂ ਕੋਲ ਜ਼ਮੀਨ ਹੈਗੀ ਹੈ ਅਤੇ ਉਨ੍ਹਾਂ ਨੇ ਵੀ ਸੀਰੀ ਰੱਖੇ ਹੋਏ ਹਨ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਨ ਲਈ ਬੰਦੇ ਰੱਖੇ ਹੋਏ ਹਨ ਅਤੇ ਬਾਕੀ ਬਾਹਰ ਸ਼ਹਿਰ ਵਿੱਚ ਨੌਕਰੀਆਂ ਕਰਦੇ ਹਨ ਨੌਜਵਾਨ ਜਿਨ੍ਹਾਂ ਵਿੱਚ ਕਿ ਸਰਕਾਰੀ ਨੌਕਰੀਆਂ ਵੀ ਹਨ ਅਤੇ ਪ੍ਰਾਈਵੇਟ ਨੌਕਰੀਆਂ ਵੀ ਹਨ